ਸਾਡੇ ਭਾਰਤ ਵਿੱਚ ਸਿਰਫ਼ ਭਾਰਤੀ ਖਾਣਾ ਹੀ ਨਹੀਂ ਬਲਕਿ ਚੀਨੀ ਇਤਾਲਵੀ ਅਤੇ ਮੈਕਸੀਕਨ ਖਾਣਾ ਵੀ ਬਹੁਤ ਵਧੀਆ ਮਿਲਦੇ ਹਨ ਮੈਂ ਮਾਨਸਾ ਵਿੱਚ ਰਹਿੰਦੀ ਹਾਂ ਅਤੇ ਇੱਥੇ ਸਿਰਫ਼ ਪੰਜਾਬੀ ਖਾਣੇ ਹੀ ਨਹੀਂ ਬਲਕਿ ਚੀਨੀ ਅਤੇ ਇਟਲਵੀ ਖਾਣਾ ਵੀ ਬਹੁਤ ਵਧੀਆ ਮਿਲਦਾ ਹੈ ਸਾਡੇ ਇਥੇ ਨੇੜੇ ਇੱਕ ਬਹੁਤ ਹੀ ਵਧੀਆ ਰੈਸਟੋਰੈਂਟ ਹੈ ਜਿਸਦਾ ਨਾਮ ਸਪਾਈਸੀ ਸਾਗਾ ਹੈ ਅਤੇ ਉੱਥੇ ਕੇਵਲ ਨਾ ਪੰਜਾਬੀ ਖਾਣਾ ਬਲਕਿ ਚੀਨੀ ਅਤੇ ਇਟਾਲੀਅਨ ਖਾਣਾ ਵੀ ਮਿਲਦਾ ਹੈ ਚੀਨੀ ਖਾਣੇ ਵਿੱਚ ਮੇਰਾ ਸਭ ਤੋਂ ਪਸੰਦ ਦਾ ਖਾਣਾ ਮੰਚੂਰੀਅਨ ਮੋਮੋਜ ਅਤੇ ਨੂਡਲਸ ਹੈ ਇਹਨਾਂ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਵੀ ਪਾਈਆਂ ਜਾਂਦੀਆਂ ਹਨ ਜੋ ਕਿ ਸਿਹਤ ਲਈ ਫ਼ਾਇਦੇਮੰਦ ਹੁੰਦੀਆਂ ਹਨ ਅਤੇ ਮੈਨੂੰ ਇੱਥੇ ਵਧੀਆ ਅਤੇ ਮੈਨੂੰ ਬਹੁਤ ਵਧੀਆ ਲੱਗਦੇ ਹਨ ਅਤੇ ਇਟਾਲੀਅਨ ਖਾਣੇ ਵਿੱਚ ਮੈਨੂੰ ਸਭ ਤੋਂ ਵਧੀਆ ਇਟਾਲੀਅਨ ਪਾਸਤਾ ਲੱਗਦਾ ਹੈ ਅਤੇ ਉਹ ਸਪਾਈਸੀ ਸਾਗਾ ਤੋਂ ਸਭ ਤੋਂ ਵਧੀਆ ਮਿਲਦਾ ਹੈ ਮਿਲਦਾ ਹੈ ਮੈਨੂੰ ਬਹੁਤ ਪਸੰਦ ਹੈ ਅਤੇ ਉਹ ਪੰਜਾਬੀ ਖਾਣੇ ਵਿੱਚ ਵੇਖਿਆ ਜਾਵੇ ਤਾਂ ਉੱਥੇ ਸ਼ਾਹੀ ਪਨੀਰ ਦਾਲ ਮੱਖਣੀ ਨਾਨ ਅਤੇ ਤੰਦੂਰੀ ਰੋਟੀ ਬਹੁਤ ਵਧੀਆ ਮਿਲਦੀ ਹੈ ਅਤੇ ਮੈਨੂੰ ਪੰਜਾਬੀ ਖਾਣਿਆਂ ਵਿੱਚ ਸਭ ਤੋਂ ਵਧੀਆ ਲੱਗਦੀ ਹੈ ਇਹ ਰੈਸਟੋਰੈਂਟ ਹੋਮ ਡਿਲੀਵਰੀ ਵੀ ਪ੍ਰੋਵਾਈਡ ਕਰਦਾ ਹੈ ਅਤੇ ਘਰ ਬੈਠੇ ਆਪਣੀ ਪਸੰਦ ਦੀ ਚੀਨੀ ਇਟਾਲੀਅਨ ਅਤੇ ਪੰਜਾਬੀ ਕੋਈ ਵੀ ਖਾਣਾ ਮੰਗਵਾ ਸਕਦੀ ਹਾਂ ਅਤੇ ਇਹ ਦੀ ਥੋੜ੍ਹੇ ਸਮੇਂ ਵਿੱਚ ਖਾਣੇ ਦੀ ਡਿਲੀਵਰੀ ਵੀ ਕਰ ਦਿੰਦੇ ਹਨ ਜੋ ਕਿ ਬਹੁਤ ਵਧੀਆ ਹੈ